ਪੰਜਾਬ ਵਿੱਚ ਮੁੱਖ ਤੌਰ 'ਤੇ ਪੰਜਾਬੀ ਅਤੇ ਹਿੰਦੀ ਵਰਗੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਕੋਈ ਕੋਈ ਵੀ ਖੇਤਰ ਹੈ ਜਿਹੜੀ ਭਾ ਭਾਸ਼ਾ ਦੇ ਅਨੁਸਾਰ ਹੀ ਪਤਾ ਲੱਗਦਾ ਹੈ ਕਿ ਕਿੱਥੋਂ ਬਿਲੋਂਗ ਕਰਦਾ ਜਿਵੇਂ ਵੀ ਜਿਵੇਂ ਕਿ ਬੰਗਾਲ ਵਿੱਚ ਬੰਗਾਲੀ ਬੋਲੀ ਜਾਂਦੀ ਹੈ ਅਤੇ ਹੋਰ ਕਈ ਭਾਸ਼ਾਵਾਂ ਹੁੰਦੀਆਂ ਹਨ ਪੰਜਾਬੀ ਦੀ ਉਪਭਾਸ਼ਾਵਾਂ ਹਨ ਜਿਵੇਂ ਦੁਆਬੀ ਹੋ ਗਈ ਮਾਝੀ ਹੋ ਗਈ ਮਲਵਈ ਹੋ ਗਈ ਜੋ ਅਲੱਗ ਅਲੱਗ ਖੇਤਰਾਂ ਦੇ ਵਿੱਚ ਬੋਲੀ ਜਾਂਦੀ ਹੈ ਪੰਜਾਬ ਦੀ ਗੁਰਮੁਖੀ ਲਿਪ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਹੈ